ਮੇਰੇ ਪਿੰਡ ਵਿੱਚ ਕਰਿਆਨੇ ਦੀਆਂ ਦੁਕਾਨਾਂ ਉਪਲੱਬਧ ਹਨ ਇੱਥੇ ਸੱਤ ਤੋਂ ਅੱਠ ਕਰਿਆਨੇ ਦੀਆਂ ਦੁਕਾਨਾਂ ਹੋਣਗੀਆਂ ਮੇਰਾ ਪਿੰਡ ਵੀ ਛੋਟਾ ਹੈ ਪਰ ਦੁਕਾਨਾਂ ਸੱਤ ਤੋਂ ਅੱਠ ਹਨ ਜਿਸ ਦਾ ਬਹੁਤ ਹੀ ਫਾਇਦਾ ਹੈ ਜਦੋਂ ਵੀ ਕੋਈ ਐਮਰਜੈਂਸੀ ਹੋਵੇ ਕੋਈ ਸ਼ੌਰਟੇਜ ਹੋ ਜਾਵੇ ਤਾਂ ਆਪਾਂ ਜਲਦੀ ਤੋਂ ਜਲਦੀ ਜਾ ਕੇ ਸਮਾਨ ਲੈ ਕੇ ਆ ਸਕਦੇ ਹਾਂ ਅਤੇ ਇੱਥੇ ਹਰੇਕ ਸਮਾਨ ਉਪਲੱਬਧ ਹੈ ਜਿਵੇਂ ਕਿ ਬੱਚਿਆਂ ਦੇ ਖੇਡਣ ਤੋਂ ਲੈ ਕੇ ਅਨਾਜ ਸਬਜ਼ੀ ਜਿਵੇਂ ਕੋਈ ਤਿਉਹਾਰ ਆਉਂਦਾ ਹੈ ਤਾਂ ਆਪਾਂ ਨੂੰ ਮਾਰਕਿਟ ਜਾਣਾ ਪੈਂਦਾ ਹੈ ਜਿਵੇਂ ਹੁਣ ਰਿਸੈਂਟਲੀ ਰਕਸ਼ਾ ਬੰਧਨ ਆਇਆ ਸੀ ਤਾਂ ਰੱਖੜੀ ਖਰੀਦਣ ਆਪਾਂ ਬਜ਼ਾਰ ਜਾਂਦੇ ਹਾਂ ਪਰ ਇੱਥੇ ਰਕਸ਼ ਰੱਖੜੀਆਂ ਵੀ ਉਪਲੱਬਧ ਹਨ ਜਿਵੇਂ ਵੀ ਕੋਈ ਤਿਉਹਾਰ ਆਉਂਦਾ ਉਸ ਦੇ ਅਕੋਡਿੰਗ ਇੱਥੇ ਆਪਾਂ ਸਮਾਨ ਖ਼ਰੀਦ ਸਕਦੇ ਹਾਂ ਅਤੇ ਨਕਦ ਉਧਾਰ ਦੋਨੋਂ ਹੀ ਚੱਲਦਾ ਹੈ ਇੱਥੇ ਦੁਕਾਨਦਾਰ ਦਾ ਵਿਵਹਾਰ ਬਹੁਤ ਹੀ ਸਹੀ ਹੁੰਦਾ ਹੈ ਜਿਵੇਂ ਵੈਸੇ ਤਾਂ ਇੱਥੇ ਨਕਦ ਜ਼ਿਆਦਾ ਚੱਲਦਾ ਹੈ ਬਟ ਅਗਰ ਕਿਸੇ ਨੂੰ ਜ਼ਿਆਦਾ ਹੀ ਤੰਗੀ ਹੋਵੇ ਕੋਈ ਗਰੀਬ ਹੈ ਤਾਂ ਉਹਨਾਂ ਨੂੰ ਉਹ ਉਧਾਰ ਵੀ ਦੇ ਦਿੰਦੇ ਹਨ ਜੋ ਕਿ ਸਮੇਂ ਸਿਰ ਆਪਣਾ ਉਧਾਰ ਚੁਕਾਵੇਗਾ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਚੀਜ਼ਾਂ ਵੀ ਬਹੁਤ ਉਪਲੱਬਧ ਹਨ ਤਾਂ ਦੇਖਿਆ ਜਾਵੇ ਤਾਂ ਕਰਿਆਨੇ ਦੀਆਂ ਦੁਕਾਨਾਂ ਅਤੇ ਦੁਕਾਨਦਾਰ ਉਹਨਾਂ ਦਾ ਸਾਡੇ ਪਿੰਡ ਵਿੱਚ ਬਹੁਤ ਹੀ ਫਾਇਦਾ ਹੈ